ਮੀਡੀਆ ਜਿਵੇਂ ਕਿ ਰੈਡੀਓ ਟੈਲੀਵਿਜ਼ਨ ਅਤੇ ਪ੍ਰਿੰਟ ਮੀਡੀਆ ਦੀ ਵਰਤੋਂ ਨਾਲ ਲੋਕਾਂ ਤੱਕ ਆਪਣੇ ਵਿਚਾਰਾਂ ਨੂੰ ਰੱਖਿਆ ਜਾ ਸਕਦਾ ਹੈ ਰੈਡੀਓ ਵਿੱਚ ਸਾਨੂੰ ਸੁਣ ਕੇ ਸਰਕਾਰ ਔਰ ਰੋਜ਼ਾਨਾ ਦੀਆਂ ਖ਼ਬਰਾਂ ਦਾ ਪਤਾ ਚੱਲਦਾ ਹੈ ਟੈਲੀਵਿਜ਼ਨ 'ਤੇ ਅਸੀਂ ਦੇਖ ਸਕਦੇ ਹਾਂ ਅਤੇ ਉਸਦੇ ਨਾਲ ਜਾਣਕਾਰੀ ਲੈ ਸਕਦੇ ਹਾਂ ਲਿਖੀ ਹੋਈ ਜਾਣਕਾਰੀ ਵੀ ਲੈ ਸਕਦੇ ਹਾਂ ਅਤੇ ਪ੍ਰਿੰਟ ਮੀਡੀਆ ਵਿੱਚ ਜਿਵੇਂ ਕਿ ਅਖ਼ਬਾਰਾਂ ਇਹਨਾਂ ਨੂੰ ਪੜ੍ਹ ਕੇ ਗਿਆਨ ਹਾਸਿਲ ਕੀਤਾ ਜਾ ਸਕਦਾ ਹੈ ਜਿਸ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀ ਸਟੋਰੀਜ ਐਜੂਕੇਸ਼ਨ ਇਨਵਾਇਰਮੈਂਟ ਅਤੇ ਹੋਰ ਅਗਾਂਹ ਵਧੂ ਚੀਜ਼ਾਂ ਦੇ ਬਾਰੇ ਜਾਣਕਾਰੀ ਮਿਲਦੀ ਹੈ ਅਤੇ ਪੰਜਾਬੀ ਭਾਸ਼ਾ ਨੂੰ ਬਹੁਤ ਸੁੰਦਰ ਤਰੀਕੇ ਨਾਲ ਉਲੀਕਿਆ ਜਾਂਦਾ ਹੈ ਪ੍ਰਿੰਟ ਕੀਤਾ ਜਾਂਦਾ ਹੈ ਤਾਂ ਕਿ ਉਸ ਦੇ ਵਿੱਚ ਲਗਾਂ ਮਾਤਰਾ ਹਰ ਚੀਜ਼ ਦਾ ਖਿਆਲ ਰੱਖ ਕੇ ਲੋਕਾਂ ਨੂੰ ਸਹੀ ਜਾਣਕਾਰੀ ਦਿੱਤੀ ਜਾਂਦੀ ਹੈ